ਟੈਲੀਮੈਡੀਸਨ ਕਰਕੇ ਲੋਕਾਂ ਨੂੰ ਕਈ ਫਾਇਦੇ ਹੋਏ ਹਨ ਜਿਵੇਂ ਲੋਕਾਂ ਦਾ ਲਾਈਨਾਂ 'ਚ ਲੱਗਣਾ ਘੱਟ ਹੋ ਗਿਆ ਹੈ ਅਤੇ ਸਮੇਂ ਵੀ ਬਚਦਾ ਹੈ ਡੋਕਟਰ ਡਰੈਕਟ ਟੈਲੀਮੈਡ ਟੈਲੀ ਕੋਲਸ ਕਰ ਕੇ ਡੋਕ ਪੇਸ਼ੈਂਟ ਦਾ ਹਾਲ ਪੁੱਛ ਲੈਂਦੇ ਹਨ ਅਤੇ ਉਹਨਾਂ ਨੂੰ ਦਵਾਈ ਰਿਕਮੈਂਡ ਕਰ ਦਿੰਦੇ ਹਨ